ਵੈਸੇ ਤਾਂ ਪਟਿਆਲਾ ਸ਼ਹਿਰ ਵਿੱਚ ਬਹੁਤ ਸਾਰੇ ਧਾਰਮਿਕ ਅਸਥਾਨ ਹਨ ਪਰ ਜੇ ਮੈਂ ਆਪਣੇ ਘਰ ਦੇ ਨੇੜੇ ਦੇ ਧਾਰਮਿਕ ਅਸਥਾਨ ਦੀ ਗੱਲ ਕਰਾਂ ਤਾਂ ਓਹ ਕਾਲੀ ਮਾਤਾ ਮੰਦਰ ਹੈ ਜੋ ਕਿ ਸਾਡੇ ਪਟਿਆਲੇ ਵਿੱਚ ਕਾਫੀ ਸਾਲਾਂ ਤੋਂ ਸਥਿਤ ਹੈ ਅਤੇ ਇੱਥੇ ਕਈ ਲੋਕ ਯਾਤਰਾ ਕਰਨ ਲਈ ਆਉਂਦੇ ਹਨ ਇਹ ਇਹ ਮੰਦਰ ਸਾਡੇ ਪਲੇ ਪਟਿਆਲੇ ਵਿੱਚ ਬਹੁਤ ਜ਼ਿਆਦਾ ਮਸ਼ਹੂੂਰ ਹੈ ਸਾਡੇ ਕਈ ਰਿਸ਼ਤੇਦਾਰ ਵੀ ਇੱਥੇ ਏ ਮੱਥਾ ਟੇਕਣ ਲਈ ਆਉਂਦੇ ਹਨ ਜੇਕਰ ਮੈਂ ਕਹਾਂ ਕਿ ਸਾਨੂੰ ਇਸ ਇੱਥੇ ਕਿਹੜੇ ਮੌਸਮ ਵਿੱਚ ਜਾਣਾ ਚਾਹੀਦਾ ਹੈ ਤਾਂ ਪਟਿਆਲਾ ਵਿੱਚ ਗਰਮੀ ਜ਼ਿਆਦਾ ਪੈਂਦੀ ਹੈ ਤਾਂ ਇਸ ਲਈ ਮੈਂ ਤਾਂ ਇਹ ਸਲਾਹ ਦੇਵਾਂਗੀ ਕਿ ਸਾਨੂੰ ਉੱਥੇ ਗਰਮੀ ਵਿੱਚ ਉੱਥੇ ਦੀ ਯਾਤਰਾ ਕਰਨੀ ਚਾਹੀਦੀ ਹੈ ਸਾਡਾ ਕੋਈ ਰਿਸ਼ਤੇਦਾਰ ਜੇਕਰ ਸਾਥੋਂ ਪੁੱਛਦਾ ਹੈ ਇੱਥੇ ਘੁੰਮਣ ਲਈ ਤਾਂ ਅਸੀਂ ਇਹੀ ਕਹਿੰਦੇ ਹਾਂ ਕਿ ਸਾਨੂੰ ਇੱਥੇ ਸਰਦੀਆਂ ਵਿੱਚ ਆਉਣਾ ਚਾਹੀਦਾ ਹੈ